ਬਿਜਲੀ ਦਾ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਫਾਇਦਾ ਹੈ ਜਿਵੇਂ ਕਿ ਰੋਸ਼ਨੀ ਕਰਨ ਲਈ ਗਰਮ ਕਰਨ ਲਈ ਕੁਛ ਠੰਢਾ ਕਰਨ ਲਈ ਜਾਂ ਆਵਾਜਾਈ ਦੇ ਸਾਧਨ ਅਤੇ ਹੋਰ ਬਿਜਲਈ ਦੇ ਉਪਕਰਨ ਇਸੇ ਤਰ੍ਹਾਂ ਘਰਾਂ ਵਿੱਚ ਬਿਜਲੀ ਦਾ ਫਾਇਦਾ ਹੈ ਕਿ ਰੋ ਜਿਵੇਂ ਕਿ ਰੋਸ਼ਨੀ ਕਰਨਾ ਗਰਮ ਕਰਨਾ ਠੰਢਾ ਕਰਨਾ ਜਾਂ ਵਾਤਾਕੁਲਨ ਵਾਤਾਅਨੁਕੂਲਨ ਦੀ ਮਦਦ ਨਾਲ ਬਿਜਲਈ ਉਪਕਰਨ ਜਿਵੇਂ ਫਰਿੱਜ ਕੱਪੜੇ ਧੋਣ ਦੀ ਮਸ਼ੀਨ ਭਾਂਡੇ ਧੋਣ ਦੀ ਮਸ਼ੀਨ ਖਾਣਾ ਬਣਾਉਣ ਦੀ ਮਸ਼ੀਨ ਪੱਖੇ ਕੱਦੂਕਸ ਕਰਨ ਦੀ ਮਸ਼ੀਨ ਅਤੇ ਇਸੇ ਤਰ੍ਹਾਂ ਦੇ ਹੋਰ ਉਪਕਰਨ ਜੋ ਕਿ ਬਿਜਲੀ ਨਾਲ ਚੱਲਦੇ ਹਨ ਬਿਜਲੀ ਸਾਡੇ ਘਰਾਂ ਦਾ ਤਾਂ ਕੀ ਹੀ ਕਹਿਣਾ ਸਾਡੀ ਜ਼ਿੰਦਗੀ ਦਾ ਹੀ ਇੱਕ ਮਹੱਤਵਪੂਰਨ ਹਿੱਸਾ ਹੈ ਇੱਥੋਂ ਤੱਕ ਕਿ ਆਵਾਜਾਈ ਦੇ ਦੋ ਤਿੰਨ ਅਤੇ ਚਾਰ ਪਹੀਆ ਵਾਹਨ ਵੀ ਬਿਜਲੀ ਨਾਲ ਚੱਲਣ ਲੱਗ ਪਏ ਹਨ ਇਸੇ ਤਰ੍ਹਾਂ ਬਿਜਲੀ ਉਦਯੋਗਿਕ ਖੇਤਰ ਵਿੱਚ ਵੀ ਵਰਤੀ ਜਾਂਦੀ ਹੈ ਹਰ ਕਾਰਖ਼ਾਨਾ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੀ ਤੋਂ ਵੱਡੀ ਉਦਯੋਗਿਕ ਜਗ੍ਹਾ ਬਿਜਲੀ ਤੋਂ ਬਿਨਾਂ ਇੰਝ ਹੈ ਜਿਵੇਂ ਕਿ ਸਰੀਰ ਵਿੱਚ ਆਤਮਾ ਜਾਂ ਪ੍ਰਾਣ ਹੋਣਾ ਜ਼ਰੂਰੀ ਹੈ ਕਾਰਖ਼ਾਨਿਆਂ ਜਾਂ ਉਦਯੋਗਾਂ ਵਿੱਚ ਮਸ਼ੀਨਾਂ ਚਲਾਉਣ ਲਈ ਬਿਜਲੀ ਦੀ ਲੋੜ ਹੁੰਦੀ ਹੈ ਸਟੀਲ ਬਣਾਉਣ ਲਈ ਮਸ਼ੀਨਾਂ ਬਣਾਉਣ ਲਈ ਧਾਤੂਆਂ ਨੂੰ ਕੱਢਣ ਲਈ ਬਿਜਲੀ ਦੀ ਹੀ ਲੋੜ ਹੈ ਇੱਥੋਂ ਤੱਕ ਕਿ ਮੈਡੀਕਲ ਖੇਤਰ ਵਿੱਚ ਵੀ ਬਿਜਲੀ ਨਾਲ ਹੀ ਸਭ ਕੁਝ ਹੁੰਦਾ ਹੈ ਇਸ ਸਭ ਕੁਝ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਬਿਜਲੀ ਬਹੁਤ ਜ਼ਰੂਰੀ ਹੈ ਜੇਕਰ ਕਿਸੇ ਵੀ ਕਾਰਨ ਕਰਕੇ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਸਾਡੀ ਜ਼ਿੰਦਗੀ ਮਾਨੋ ਖੜ੍ਹ ਹੀ ਜਾਂਦੀ ਹੈ ਉਂਝ ਤਾਂ ਸਾਡੇ ਸ਼ਹਿਰੀ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਚੌਵੀ ਘੰਟੇ ਰਹਿੰਦੀ ਹੈ ਪੇਂਡੂ ਖੇਤਰਾਂ ਵਿੱਚ ਇਹ ਸਪਲਾਈ ਥੋੜ੍ਹੀ ਜਿਹੀ ਘੱਟ ਵੇਖੀ ਜਾਂਦੀ ਹੈ ਕਈ ਵਾਰ ਬਿਜਲੀ ਦੀ ਘਾਟ ਕਾਰਨ ਕੱਟ ਲਗਾਏ ਜਾਂਦੇ ਹਨ ਪਰ ਕਦੇ ਮੌਸਮ ਦੀ ਖਰਾਬੀ ਕਾਰਨ ਜਾਂ ਬਿਜਲੀ ਦੇ ਪਲਾਂਟ ਜਾਂ ਟ੍ਰਾਂਸਫਾਰਮਰ ਦੀ ਖਰਾਬੀ ਕਾਰਨ ਬਿਜਲੀ ਦੀ ਲਗਾਤਾਰਤਾ ਖਤਮ ਹੋ ਜਾਂਦੀ ਹੈ ਉਸ ਵੇਲੇ ਇੰਝ ਲੱਗਦਾ ਹੈ ਮਾਨੋ ਜ਼ਿੰਦਗੀ ਖੜ੍ਹ ਹੀ ਗਈ ਜੇਕਰ ਰਾਤ ਹੈ ਤਾਂ ਹਨ੍ਹੇਰਾ ਹੋ ਜਾਂਦਾ ਹੈ ਜੇਕਰ ਗਰਮੀ ਹੈ ਤਾਂ ਪੱਖੇ ਬੰਦ ਹੋ ਜਾਂਦੇ ਹਨ ਵਾਤਾਅਨੁਕੂਲਨ ਬੰਦ ਹੋ ਜਾਂਦਾ ਹੈ ਜੇਕਰ ਕੋਈ ਮਸ਼ੀਨ ਚੱਲ ਰਹੀ ਹੈ ਤਾਂ ਉਹ ਬੰਦ ਹੋ ਜਾਂਦੀ ਹੈ ਘਰਾਂ ਵਿੱਚ ਜਿਵੇਂ ਕਿ ਕੱਪੜੇ ਧੁੱਲ ਰਹੇ ਹਨ ਉਹ ਵੀ ਮਸ਼ੀਨ ਵਿੱਚ ਹੀ ਧੁੱਲ ਰਹੇ ਹਨ ਜੇਕਰ ਬਿਜਲੀ ਰੁੱਕ ਜਾਂਦੀ ਹੈ ਤਾਂ ਉਹ ਕੱਪੜੇ ਧੁੱਲਨੋਂ ਵੀ ਰੁੱਕ ਜਾਂਦੇ ਹਨ ਜੇਕਰ ਭਾਂਡੇ ਧੋਤੇ ਜਾ ਰਹੇ ਹਨ ਤਾਂ ਮਸ਼ੀਨ ਬੰਦ ਹੋਣ ਕਾਰਨ ਉਹ ਵੀ ਅੱਧ ਵਿਚਾਲੇ ਰਹਿ ਜਾਂਦੇ ਹਨ ਇਸੇ ਤਰ੍ਹਾਂ ਹਰ ਕੰਮ ਜੋ ਮਸ਼ੀਨ ਨਾਲ ਹੋ ਰਿਹਾ ਹੈ ਉਹ ਰੁੱਕ ਜਾਂਦਾ ਹੈ ਅੱਜ ਕੱਲ੍ਹ ਜਿਵੇਂ ਕਿ ਬਿਜਲੀ ਦੇ ਵਾਹਨ ਆ ਗਏ ਹਨ ਤਾਂ ਅਗਰ ਕੋਈ ਸਕੂਟਰ ਦੋ ਪਹੀਆ ਵਾਹਨ ਚਾਰਜ ਕੀਤਾ ਜਾ ਰਿਹਾ ਹੈ ਜਾਂ ਤਿੰਨ ਪਹੀਆ ਜਾਂ ਚਾਰ ਪਹੀਆ ਵਾਹਨ ਚਾਰਜ ਕੀਤਾ ਜਾ ਰਿਹਾ ਹੈ ਅਤੇ ਬਿਜਲੀ ਦੀ ਲਗਾਤਾਰਤਾ ਖਤਮ ਹੋ ਗਈ ਹੈ ਤਾਂ ਉਹ ਵੀ ਅੱਧ ਵਿਚਾਲੇ ਹੀ ਰੁੱਕ ਜਾਵੇਗੀ ਇਸੇ ਤਰ੍ਹਾਂ ਘਰ ਵਿੱਚ ਮਾਨੋ ਛੋਟੇ ਬੱਚੇ ਹਨ ਉਹ ਗਰਮੀ ਕਾਰਨ ਸੁੱਤੇ ਪਏ ਉੱਠ ਜਾਣਗੇ ਅਗਰ ਸਰਦੀਆਂ ਹਨ ਹੀਟਰ ਚੱਲ ਰਿਹਾ ਹੈ ਤਾਂ ਹੀਟਰ ਬੰਦ ਹੋ ਜਾਵੇਗਾ ਇਸੇ ਤਰ੍ਹਾਂ ਮਨੋਰੰਜਨ ਦੇ ਸਾਧਨ ਜਿਵੇਂ ਕਿ ਟੀ ਵੀ ਕੰਪਿਊਟਰ ਲੈਪਟੋਪ ਇਹ ਵੀ ਸਾਰੇ ਬਿਜਲੀ ਨਾਲ ਹੀ ਚੱਲਦੇ ਹਨ ਇੰਟਰਨੈੱਟ ਵੀ ਬਿਜਲੀ ਨਾਲ ਹੀ ਚੱਲਦਾ ਹੈ ਬਿਜਲੀ ਦੀ ਲਗਾਤਾਰਤਾ ਖਤਮ ਹੋਣ ਨਾਲ ਇਹ ਵੀ ਬੰਦ ਹੋ ਜਾਣਗੇ ਸਾਡੀ ਜ਼ਿੰਦਗੀ ਮਾਨੋ ਖੜ੍ਹ ਹੀ ਜਾਂਦੀ ਹੈ